ਮੇਰੇ ਖਿਆਲ ਵਿੱਚ ਅੱਜ ਸਮਾਜ ਵਿੱਚ ਟੈਕਨੋਲੋਜੀ ਬਹੁਤ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਟੈਕਨੋਲੋਜੀ ਨਾਲ ਅਸੀਂ ਘਰ ਬੈਠ ਕੇ ਦੂਸਰੇ ਬੰਦੇ ਨਾਲ ਕਿਤੇ ਵੀ ਬੈਠਾ ਹੋਵੇ ਗੱਲ ਕਰ ਸਕਦੇ ਹਾਂ ਅਤੇ ਅਸੀਂ ਟੈਕਨੋਲਜੀ ਰਾਹੀਂ ਘਰ ਬੈਠੇ ਹੀ ਬਹੁਤ ਕੁਝ ਕਰ ਸਕਦੇ ਹਾਂ ਜਿਵੇਂ ਕਿ ਘਰ ਬੈਠੇ ਦੂਜੇ ਬੰਦੇ ਨਾਲ ਗੱਲ ਕਰ ਸਕਦੇ ਹਾਂ ਅਸੀਂ ਪਰ ਬੈਠੇ ਹੀ ਪੈਸੇ ਵਗੈਰਾ ਟਰਾਂਸਫਰ ਜਾਂ ਕ੍ਰੈਡਿਟ ਕਰਾ ਸਕਦੇ ਹਾਂ ਫਿਰ ਹੋਰ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਘਰ ਬੈਠੇ ਹੀ ਆਪਣੇ ਖਾਣ ਪੀਣ ਵਾਸਤੇ ਕੁਝ ਵੀ ਮੰਗਵਾ ਸਕਦੇ ਹਾਂ ਸ਼ੋਪਿੰਗ ਵਗੈਰਾ ਘਰ ਬੈਠ ਕੇ ਹੀ ਕਰ ਸਕਦੇ ਹਾਂ ਜੋ ਕਿ ਸਾਰਾ ਕੁਝ ਟੈਕਨੋਲਜੀ ਨਾਲ ਹੀ ਬਣਿਆ ਹੈ ਜੇਕਰ ਟੈਕਨੋਲੋਜੀ ਨਾ ਹੁੰਦੀ ਤਾਂ ਇਹ ਸਭ ਨਹੀਂ ਹੁੰਦਾ ਹੁਣ ਅਸੀਂ ਘਰ ਬੈਠੇ ਹੀ ਬਹੁਤ ਕੁਝ ਕਰ ਸਕਦੇ ਹਾਂ ਟੈਕਨੋਲਜੀ ਦੇ ਕਰਕੇ ਟਕਨੋਲਜੀ ਇੱਕ ਇਹੋ ਜਿਹਾ ਟੈਕਨੋਲਜੀ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨੇ ਸਾਡੀ ਗ੍ਰਹਿਸਤੀ ਨੂੰ ਬਹੁਤ ਵਧੀਆ ਕਰ ਦਿੱਤਾ ਹੈ ਘਰ ਬੈਠੇ ਹੀ ਕਿਤੇ ਬਾਹਰ ਜਾਣ ਦੀ ਪਲੈਨਿੰਗ ਕਰ ਸਕਦੇ ਹਾਂ ਟਰੇਨ ਬੁੱਕ ਹੋ ਸਕਦੀ ਹੈ ਬਸ ਬੁੱਕ ਹੋ ਸਕਦੀ ਹੈ ਅੱਜ ਕੱਲ੍ਹ ਤਾਂ ਬਾਈਕ ਵੀ ਬੁੱਕ ਹੋ ਸਕਦੀ ਹੈ ਜੋ ਕਿ ਸਾਰਾ ਕੁਝ ਟੈਕਨੋਲੋਜੀ ਦੇ ਮਾਧਿਅਮ ਨਾਲ ਹੀ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ ਵਿੱਚ ਬਹੁਤ ਅੰਤਰ ਪਿਆ ਹੈ ਕੁਝ ਵੀ ਉਹ ਗੂਗਲ 'ਤੇ ਜਾਂ ਯੂਟੀਊਬ 'ਤੇ ਸਰਚ ਮਾਰ ਕੇ ਕਰ ਸਕਦੇ ਹਨ ਜੋ ਕਿ ਇਹ ਵੱਖ ਵੱਖ ਤਰ੍ਹਾਂ ਦਾ ਹੈ ਅੱਜ ਕੱਲ੍ਹ ਅਸੀਂ ਕੋਈ ਵੀ ਭਾਸ਼ਾ ਨੂੰ ਆਪਣੇ ਬਣਾ ਸਕਦੇ ਹਾਂ ਬੋਲ ਸਕਦੇ ਹਾਂ ਸਿੱਖ ਸਕਦੇ ਹਾਂ ਇਹ ਸਾਰਾ ਕੁਛ ਟੈਕਨੋਲੋਜੀ ਦੇ ਕਰਕੇ ਹੀ ਹੋਇਆ ਹੈ ਇਸ ਕਰਕੇ ਸਾਨੂੰ ਟੈਕਨੋਲੋਜੀ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਟੈਕਨੋਲੋਜੀ ਨੂੰ ਸਹੀ ਰੂਪ ਵਿੱਚ ਵਰਤਣਾ ਚਾਹੀਦਾ ਹੈ ਤਾਂ ਜੋ ਸਾਡਾ ਭਵਿੱਖ ਇਕਦਮ ਸੁਰਕਸ਼ਿਤ ਰਹੇ ਧੰਨਵਾਦ